ਮੈਂ ਕੀ ਬਣਾਉਣਾ ਉਸ ਦਾ ਫੈਸਲਾ ਮੈਂ ਕਾਫੀ ਚੀਜ਼ਾਂ ਤੋਂ ਪ੍ਰਭਾਵਿਤ ਹੋ ਕੇ ਕਰਦਾ ਹਾਂ ਜਿਵੇਂ ਇਸ ਚੀਜ਼ ਨੂੰ ਕਿੱਦਾਂ ਲੋਕ ਵੇਖਦੇ ਹਨ ਉਹ ਅਸਲ 'ਚ ਚੀਜ਼ ਕਿਵੇਂ ਦੀ ਹੈ ਅਤੇ ਮੈਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦਿਖਾ ਸਕਦਾ ਹਾਂ ਇਸ ਤੋਂ ਇਲਾਵਾ ਮੈਂ ਕਾਫੀ ਚਿੱਤਰਕਾਰਾਂ ਦੀ ਚਿੱਤਰਕਾਰੀ ਵੀ ਵੇਖਦਾ ਹਾਂ ਅਤੇ ਉਸ ਤੋਂ ਪ੍ਰਭਾਵਿਤ ਹੋ ਕੇ ਉਸ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਪੂਰੀ ਕਰਦਾ ਹਾਂ ਅਤੇ ਚਿੱਤਰਕਾਰੀ ਦੇ ਲਈ ਮੇਰੀ ਇੱਕ ਥੀਮ ਹੈ ਕਿ ਮੈਂ ਐਨਮਿ ਕਰੈਕਟਰ ਕਾਫੀ ਵਧੀਆ ਬਣਾਉਂਦਾ ਹਾਂ ਕਿਉਂਕਿ ਇਹ ਮੈਂ ਕਾਫੀ ਦੇਖਦਾ ਹਾਂ ਇਸ ਲਈ ਇਹ ਮੇਰੇ ਤੋਂ ਵਧੀਆ ਬਣ ਜਾਂਦੇ ਨੇ ਅਤੇ ਨਾਲ ਮੈਂ ਪਹਾੜਾਂ ਦੀ ਜੰਗਲਾਂ ਦੀ ਅਤੇ ਨਦੀਆਂ ਦੀ ਚਿੱਤਰਕਾਰੀ ਵੀ ਵਧੀਆ ਕਰਦਾ ਹਾਂ ਇਹਨਾਂ ਦੀ ਚਿੱਤਰਕਾਰੀ ਨਾਲ ਮੇਰਾ ਮਨ ਸ਼ਾਂਤ ਹੁੰਦਾ ਹੈ ਇਸ ਤੋਂ ਇਲਾਵਾ ਮੈਂ ਸ਼ੇਡਿੰਗ ਅਤੇ ਓਇਲ ਚਿੱਤਰਕਾਰੀ ਅਤੇ ਦੂਜੀ ਤਰ੍ਹਾਂ ਦੀ ਚਿੱਤਰਕਾਰੀ ਵੀ ਕਰਦਾ ਹਾਂ ਕਿਉਂਕਿ ਇਹ ਮੇਰੇ ਲਈ ਕਾਫੀ ਵਧੀਆ ਰੁਚੀ ਵਾਲੀ ਚੀਜ਼ ਹੈ ਇਸ ਦੇ ਵਿੱਚ ਮੇਰਾ ਮਨ ਕਾਫੀ ਲੱਗਾ ਰਹਿੰਦਾ ਹੈ ਅਤੇ ਇਸ ਤੋਂ ਇਲਾਵਾ ਜੇ ਦੇਖਿਆ ਜਾਵੇ ਤਾਂ ਚਿੱਤਰਕਾਰੀ ਲਈ ਮੈਂ ਸਮਾਂ ਕੱਢ ਲੈਂਦਾ ਹਾਂ ਆਪਣੇ ਲਈ ਕਿਉਂਕਿ ਇਸ ਨਾਲ ਮਨ ਮੇਰਾ ਸ਼ਾਂਤ ਰਹਿੰਦਾ ਹੈ ਅਤੇ